ਮੈਨੂੰ ਪੇਂਟਿੰਗ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਇਹ ਮੇਰੀ ਰੁਚੀ ਹੈ ਮੈਂ ਜਦੋਂ ਵੀ ਪੇਂਟਿੰਗ ਬਣਾਉਣਾ ਚਾਹੁੰਦਾ ਐ ਤਾਂ ਮੈਂ ਹਮੇਸ਼ਾ ਪਹਾੜਾ ਵੱਲ ਰੁਖ ਕਰਦਾ ਮੈਂ ਪਹਾੜਾ ਵਿੱਚ ਇੱਕ ਅਜਿਹੀ ਥਾਂ ਲੱਭਦਾ ਜਿੱਥੇ ਮੈਂ ਪੰਦਰਾਂ ਪੰਦਰਾਂ ਵੀਹ ਵੀਹ ਮਹੀਨਾ ਮਹੀਨਾ ਰਹਾਂ ਅਤੇ ਸਿਰਫ ਮੈਨੂੰ ਉੱਥੋਂ ਪਹਾੜਾਂ ਦੀ ਬਰਫ ਦੀ ਝਰਨਿਆਂ ਦੀ ਜਿਹੜੇ ਕੁਦਰਤੀ ਨਜ਼ਾਰੇ ਹੈ ਉਹ ਦਿਖਣ ਫਿਰ ਮੈਂ ਉਹਨਾਂ ਨਜ਼ਾਰਿਆਂ ਨੂੰ ਆਪਣੇ ਪੇਪਰ 'ਤੇ ਪਰੋ ਸਕਾਂ ਇਸ ਲਈ ਮੈਂ ਜਦੋਂ ਵੀ ਪੇਂਟਿੰਗ ਬਣਾਉਣਾ ਚਾਹੁੰਦਾ ਤਾਂ ਮੈਂ ਹਮੇਸ਼ਾ ਕੁਦਰਤ ਵੱਲ ਹੀ ਰੁਖ ਕਰਦਾ ਮੈਂ ਕਦੇ ਲੇਹ ਜਾਂਦਾ ਕਦੇ ਲੱਦਾਖ ਜਾਂਦਾ ਅਤੇ ਸਾਲ ਦੇ ਵਿੱਚ ਜਿਹੜੇ ਆ ਤਿੰਨ ਤਿੰਨ ਮਹੀਨੇ ਕੁਦਰਤੀ ਨਜ਼ਾਰਿਆਂ ਵਿੱਚ ਹੀ ਬਤੀਤ ਕਰਦਾ ਅਤੇ ਆਪਣੀ ਜਿਹੜੀ ਪੇਂਟਿੰਗ ਹੈ ਉਹ ਤਿਆਰ ਕਰਦਾ ਥੈਂਕਸ ਅ ਲੋਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ